ਅੱਜ ਕੱਲ੍ਹ ਦੀਆਂ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ ਹਨ ਜਿਵੇਂ ਕਿ ਇੰਸਟਾਗ੍ਰਾਮ ਵਟਸਐੱਪ ਫੇਸਬੁੱਕ ਸਨੈਪਚੈਟ ਟਵਿੱਟਰ ਅਤੇ ਹੋਰ ਹੀ ਇੱਦਾਂ ਦੀਆਂ ਕਈ ਸੋਸ਼ਲ ਮੀਡੀਆ ਐਪਸ ਹਨ ਜੇਕਰ ਆਪਾਂ ਜੇਕਰ ਅਸੀਂ ਗੱਲ ਕਰੀਏ ਸਮਾਰਟ ਫ਼ੋਨ ਦੇ ਫਾਇਦੇ ਅਤੇ ਨੁਕਸਾਨ ਬਾਰੇ ਪਹਿਲੀ ਗੱਲ ਤਾਂ ਇਸ ਦੇ ਬਹੁਤ ਹੀ ਜ਼ਿਆਦਾ ਫਾਇਦੇ ਹਨ ਜਿਵੇਂ ਕੀ ਅਸੀਂ ਸਮਾਰਟ ਫ਼ੋਨ ਨਾਲ ਘਰ ਬੈਠੇ ਪੈਸੇ ਕਮਾ ਸਕਦੇ ਹਾਂ ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ ਵੀਡੀਓ ਕਾਲ ਕਰ 'ਤੇ ਗੱਲ ਕਰ ਸਕਦੇ ਹਾਂ ਅਤੇ ਹੋਰ ਵੀ ਬਹੁਤ ਹੀ ਤਰੀਕਿਆਂ ਦੇ ਆਪਣੇ ਕੰਮ ਕਰ ਸਕਦੇ ਹਾਂ ਜਿੱਦਾਂ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਜਾਂ ਕੋਈ ਵੀ ਹੋਰ ਤਰੀਕੇ ਦੇ ਕੰਮ ਕਰ ਸਕਦੇ ਹਾਂ ਇਸ ਦੇ ਫਾਇਦੇ ਦੇ ਨਾਲ ਨਾਲ ਇਸ ਦੇ ਕਈ ਬਹੁਤ ਹੀ ਖ਼ਤਰਨਾਕ ਨੁਕਸਾਨ ਵੀ ਹਨ ਜਿਵੇਂ ਕਿ ਇਸ ਦੀ ਸਕਰੀਨ ਦੀ ਰੋਸ਼ਨੀ ਨਾਲ ਸਾਡੀਆਂ ਅੱਖਾਂ ਨੂੰ ਬਹੁਤ ਹੀ ਨੁਕਸਾਨ ਪੁੱਜਦਾ ਹੈ ਅਸੀਂ ਆਪਣਾ ਸਮਾਂ ਵੀ ਬਹੁਤ ਬਰਬਾਦ ਕਰਦੇ ਹਾਂ ਕਈ ਲੋਕ ਤਾਂ ਸਾਰਾ ਸਾਰਾ ਦਿਨ ਫ਼ੋਨ 'ਤੇ ਹੀ ਲੱਗੇ ਰਹਿੰਦੇ ਹਨ ਅਤੇ ਇਸ ਦੇ ਨਾਲ ਨਾਲ ਫ਼ੋਨ ਹੈਕ ਹੋਣ ਦੇ ਡਰ ਨਾਲ ਸਾਨੂੰ ਹੋ ਸਾਨੂੰ ਸਾਡੇ ਪੈਸੇ ਦਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ